ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਸੀਂ ਅੱਜ ਆਪਣੇ ਧਰਮ ਦੀ ਗੱਲ ਕਰਦੇ ਹਾਂ ਕਿ ਸਾਡਾ ਧਰਮ ਜਿਹੜਾ ਸਾਨੂੰ ਸਮਾਜ ਸੇਵਾ ਬਾਰੇ ਕੀ ਸਿਖਾਉਂਦਾ ਹੈ ਸਾਡਾ ਧਰਮ ਸਾਨੂੰ ਸਮਾਜ ਸੇਵਾ ਬਾਰੇ ਬਹੁਤ ਕੁਝ ਸਿਖਾਉਂਦਾ ਹੈ ਉਹ ਕਹਿੰਦਾ ਹੈ ਕਿ ਤੁਸੀਂ ਆਪਣੇ ਧਰਮ ਦੇ ਰਸਤੇ 'ਤੇ ਚੱਲੋ ਅਤੇ ਸਮਾਜ ਸੇਵਾ ਕਰੋ ਸਮਾਜ ਸੇਵਾ ਉਹ ਕਹਿੰਦਾ ਹੈ ਕਿ ਇੰਨੀ ਕੁ ਜ਼ਿਆਦਾ ਕਰੋ ਕਿ ਤੁਸੀਂ ਸਮਾਜ ਸੇਵਾ ਦੇ ਵਿੱਚ ਹੀ ਲੱਗੇ ਰਹੋ ਸਮਾਜ ਸੇਵਾ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਾਨੂੰ ਆਪਣੇ ਧਰਮ ਦੇ ਨਾਲ ਚੱਲਣਾ ਸਿਖਾਉਂਦੀ ਹੈ ਸਮਾਜ ਸੇਵਾ ਕਰਨ ਵਿੱਚ ਸਾਨੂੰ ਵਾਰ ਵਾਰ ਅੱਗੇ ਆ ਆਉਣ ਦਾ ਅਭਿਆਸ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਜਿਹੜੀ ਸਮਾਜ ਸੇਵਾ ਹੈ ਉਹ ਬੜੇ ਚੰਗੇ ਤਰੀਕੇ ਨਾਲ ਹੋ ਸਕੇ ਆਪਣੇ ਧਰਮ ਨੂੰ ਚਲਾਉਣ ਲਈ ਅਸੀਂ ਸਮਾਜ ਸੇਵਾ ਕਰਦੇ ਹਾਂ ਸਮਾਜ ਸੇਵਾ ਕਰਨ ਵਿੱਚ ਸਾਨੂੰ ਬਹੁਤ ਹੀ ਇਹ ਮੁਸ਼ਕਿਲਾਂ ਨਹੀਂ ਆਉਂਦੀਆਂ ਕਿਉਂਕਿ ਸਮਾਜ ਸੇਵਾ ਅਸੀਂ ਬੜੇ ਹੀ ਸੌਖੇ ਤਰੀਕੇ ਨਾਲ ਕਰ ਸਕਦੇ ਹਾਂ ਅਸੀਂ ਆਪਣੇ ਸਾਰੇ ਭਾਈਚਾਰੇ ਨੂੰ ਲੈ ਕੇ ਨਾਲ ਚੱਲੀਏ ਤਾਂ ਇਹ ਸਮਾਜ ਸੇਵਾ ਹੋ ਜਾਂਦੀ ਹੈ ਜਦੋਂ ਵੀ ਸਾਨੂੰ ਕੋਈ ਬਜ਼ੁਰਗ ਜਾਂ ਕੋਈ ਵੀ ਇਨਸਾਨ ਕਿਤੇ ਕੋਈ ਦੁੱਖ ਤਕਲੀਫ ਵਿੱਚ ਮਿਲਦਾ ਹੈ ਅਤੇ ਸਾਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ ਇਹ ਵੀ ਇੱਕ ਤਰ੍ਹਾਂ ਦੀ ਸਮਾਜ ਸੇਵਾ ਹੀ ਹੈ ਜੇ ਕੋਈ ਕੋਈ ਪਿਆਸਾ ਸਾਨੂੰ ਕਿਤੇ ਰਸਤੇ 'ਚ ਮਿਲਦਾ ਹੈ ਤਾਂ ਉਸ ਕੋਲ ਪਾਣੀ ਨਹੀਂ ਹੁੰਦਾ ਤਾਂ ਉਸਨੂੰ ਅਸੀਂ ਪਾਣੀ ਦੇ ਦਿ ਦਿੰਦੇ ਹਾਂ ਪੀਣ ਵਾਸਤੇ ਤਾਂ ਇਹ ਵੀ ਇੱਕ ਸਮਾਜ ਸੇਵਾ ਹੈ ਜਦੋਂ ਅਸੀਂ ਤੁਹਾਡੇ ਦੁਆਰਾ ਸਮਾਜ ਸੇਵਾ ਉਹ ਕਰਨ ਵਿੱਚ ਤੁਹਾਡੀ ਤੁਹਾਡੇ ਨਾਲ ਸਮਾਜ ਸੇਵਾ ਕਰਨ ਵਿੱਚ ਖੜ੍ਹੇ ਹੁੰਦੇ ਹਾਂ ਤਾਂ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਇਸ ਨੂੰ ਚੰਗੇ ਤਰੀਕੇ ਨਾਲ ਸੇਵਾ ਕਰੀਏ ਤਾਂ ਕਿ ਸਾਨੂੰ ਚੰਗਾ ਲੱਗੇ ਜਦੋਂ ਅਸੀਂ ਸਮਾਜ ਸੇਵਾ ਕਰਦੇ ਹਾਂ ਸਾਨੂੰ ਆਪਣੇ ਕਿਸੇ ਵੀ ਕੋਈ ਲੈਣ ਦੇਣ ਦਾ ਕੋਈ ਵੀ ਵਿੱਚ ਸਾਨੂੰ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਇੱਥੋਂ ਕੁਛ ਹਾਸਿਲ ਮਿਲੇ ਸਾਨੂੰ ਬਸ ਇਹੋ ਹੀ ਰੱਖਣਾ ਹੈ ਆਪਣਾ ਪ੍ਰਣ ਕਿ ਅਸੀਂ ਸਮਾਜ ਸੇਵਾ ਕਰਨੀ ਹਾਂ ਅਸੀਂ ਕਿਸੇ ਕੋਲੋਂ ਕੁਛ ਨਹੀਂ ਲੈਣਾ ਸਗੋਂ ਕਿਸੇ ਨੂੰ ਕੁਛ ਦੇਣਾ ਹੈ ਤਾਂ ਕਿ ਅਗਲਾ ਸਾਨੂੰ ਆਖੇ ਵੀ ਤੁਸੀਂ ਮੇਰਾ ਨਾਲ ਬਹੁਤ ਚੰਗਾ ਕੀਤਾ ਹੈ